ਮੇਰੀ ਭੈਣ ਨੇ ਸਰਹਿੰਦ ਤੋਂ ਜੁੱਤੀ ਭੇਜੀ ਜਿਸ ਜਿ ਜਿਸ ਜੁੱਤੀ ਨਾਲ ਮੈਂ ਕਈ ਸਾਰੇ ਵਿਆਹ ਦੇਖੇ ਕਈ ਸਾਰੇ ਪ੍ਰੋਗਰਾਮ ਵੀ ਪ੍ਰੋਗਰਾਮ ਵੀ ਦੇਖੇ ਇਸ ਨਾਲ ਪੈਰਾਂ ਵਿੱਚ ਵੀ ਕੋਈ ਤਕਲੀਫ਼ ਨਹੀਂ ਹੁੰਦੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦਰਦ ਹੁੰਦਾ ਹੈ ਇਹ ਪਾਈ ਹੋਈ ਹਰੇਕ ਸੂਟ ਨਾਲ ਬਹੁਤ ਵਧੀਆ ਲੱਗਦੀ ਹੈ ਮੈਨੂੰ ਕਈ ਰਿਸ਼ਤੇਦਾਰਾਂ ਨੇ ਵੀ ਜੁੱਤੀ ਬਾਰੇ ਦੱਸਿਆ ਹੈ ਕਿ ਬਹੁਤ ਜ਼ਿਆਦਾ ਵਧੀਆ ਹੈ